ਜੀ ਹਾਂ ਮੈਂ ਯੋਗਾ ਦੀ ਕਲਾਸ ਲਗਾਈ ਹੋਈ ਹੈ ਅਤੇ ਮੈਨੂੰ ਯੋਗਾ ਕਰਨਾ ਬਹੁਤ ਹੀ ਪਸੰਦ ਹੈ ਮੈਂ ਹਰ ਰੋਜ਼ ਸਵੇਰੇ ਛੇ ਵਜੇ ਉੱਠ ਕੇ ਯੋਗਾ ਕਰਨ ਜਾਂਦਾ ਹਾਂ ਅਤੇ ਮੇਰੇ ਜੋ ਕਿ ਕੋਚ ਹਨ ਉਹ ਬਹੁਤ ਹੀ ਵਧੀਆ ਯੋਗ ਦਾ ਤਰੀਕਾ ਸਿਖਾਉਂਦੇ ਹਨ ਅਤੇ ਮੈਂ ਹਰ ਰੋਜ਼ ਮੈਂ ਆਪਣੀ ਯੋਗ ਦਾ ਆਦੀ ਹੋ ਗਿਆ ਹਾਂ ਅਤੇ ਮੈਂ ਹਰ ਰੋਜ਼ ਹੀ ਯੋਗਾ ਕਰਦਾ ਰਹਿੰਦਾ ਹਾਂ ਇਸੇ ਤਰ੍ਹਾਂ ਅੱਜ ਸਾਡੇ ਇੱਥੇ ਸੰਡੇ ਹੈ ਅਤੇ ਜੋ ਕਿ ਅੱਜ ਸਾਨੂੰ ਛੁੱਟੀ ਹੈ ਇਸੇ ਤਰ੍ਹਾਂ ਸਾਡੀ ਅੱਜ ਯੋਗਾ ਦੀ ਕਲਾਸ ਨਹੀਂ ਲੱਗੀ ਲੇਕਿਨ ਮੈਂ ਆਪਣੇ ਘਰ ਵਿੱਚ ਯੋਗਾ ਨੂੰ ਕਰ ਰਿਹਾ ਹਾਂ ਲੇਕਿਨ ਜੋ ਵੀ ਮੈਂ ਯੋਗ ਦੇ ਆਸਣ ਕਰ ਰਿਹਾ ਹਾਂ ਅੱਜ ਮੇਰੇ ਕੋਲ ਥੋੜ੍ਹੇ ਗ਼ਲਤ ਹੋ ਰਹੇ ਸਨ ਜੋ ਕਿ ਮੇਰੇ ਫਾਦਰ ਸਾਹਿਬ ਨੇ ਮੈਨੂੰ ਦੱਸਿਆ ਕਿ ਤੂੰ ਇਹ ਜੋ ਵੀ ਯੋਗ ਦਾ ਆਸਣ

ਇਸੇ ਤਰ੍ਹਾਂ ਹੁਣ ਸਾਡੇ ਇਥੇ ਮੀਂਹ ਪੈ ਰਿਹਾ ਹੈ ਅਤੇ ਇਸੇ ਕਰਕੇ ਹੁਣ ਮੈਂ ਅੱਜ ਯੋਗਾ ਦਾ ਆਸਣ ਆਪਣੇ ਘਰ ਹੀ ਕੀਤਾ ਹੈ ਲੇਕਿਨ ਮੇਰੇ ਫਾਦਰ ਸਾਹਿਬ ਦੇ ਦੱਸਦੇ ਦੌਰਾਨ ਮੈਂ ਯੋਗਾ ਦੇ ਆਸਣ ਨੂੰ ਚੰਗੀ ਤਰ੍ਹਾਂ ਸਿੱਖਾਂਗਾ ਅਤੇ ਇਹ ਆਸਣ ਨੂੰ ਸਹੀ ਤਰ੍ਹਾਂ ਕਰਾਂਗਾ ਤਾਂ ਕਿ ਜੋ ਵੀ ਮੇਰੇ ਸਰੀਰ 'ਤੇ ਇਹ ਇਸ ਦਾ ਗ਼ਲਤ ਪ੍ਰਭਾਵ ਨਾ ਪੈ ਸਕੇ ਅਤੇ ਮੇਰੇ ਜੋ ਵੀ ਕੋਚ ਹਨ ਉਹ ਇਸਦੇ ਬਹੁਤ ਹੀ ਮੈਨੂੰ ਵਧੀਆ ਯੋਗ ਸਿਖਾਉਂਦੇ ਹਨ ਅਤੇ ਮੈਂ ਆਪਣੇ ਯੋਗ ਦੇ ਅਨੁਭਵ ਨੂੰ ਬਹੁਤ ਹੀ ਵਧੀਆ ਮਹਿਸੂਸ ਕੀਤਾ ਹੈ ਇਸ ਕਰਕੇ ਹੁਣ ਮੈਂ ਯੋਗਾ ਦਾ ਵੀ ਆਦੀ ਹੋ ਗਿਆ ਹਾਂ ਜਿਸ ਕਰਕੇ ਮੈਨੂੰ ਅੱਜ ਛੁੱਟੀ ਹੈ ਅਤੇ ਲੇਕਿਨ ਮੈਂ ਫਿਰ ਵੀ ਇਸ ਯੋਗ ਨੂੰ ਆਪਣੇ ਘਰ ਵਿੱਚ ਵੀ ਟਰਾਈ ਕਰ ਰਿਹਾ ਭਾਵੇਂ ਮੇਰੇ ਕੋਲ ਯੋਗਾ ਦਾ ਆਸਣ ਗ਼ਲਤ ਹੀ ਹੋਇਆ ਹੈ ਲੇਕਿਨ ਮੈਂ ਯੋਗਾ ਦਾ ਬਿਲਕੁਲ ਵੀ ਆਦੀ ਨਹੀਂ ਹੁਣ ਛੱਡ ਸਕਦਾ ਇਸ ਕਰਕੇ ਮੈਂ ਯੋਗਾ ਨੂੰ ਕਿਸੇ ਤਰ੍ਹਾਂ ਵੀ ਆਪਣੇ ਘਰ ਵਿੱਚ ਕਰ ਰਿਹਾ ਹਾਂ